ਤੁਸੀਂ ਲੇਖਕ ਦੀ ਚਿੰਤਾ ਨਾ ਸਵੈ ਸ਼ਕ ਨਾਲ ਕਿਵੇਂ ਨਜਿੱਠਦੇ ਹੋ ਲੇਖਕ ਦੀ ਚਿੰਤਾ ਨੂੰ ਅਸੀਂ ਬੜੇ ਗੌਰ ਨਾਲ ਦੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਜਦੋਂ ਕੋਈ ਕਹਾਣੀ ਜਾਂ ਕਵਿਤਾ ਜਾਂ ਨਾਵਲ ਲਿਖਦਾ ਹੈ ਤਾਂ ਉਸਨੂੰ ਆਪਣੇ ਅਤੇ ਕਦੇ ਨਾ ਕਦੇ ਸਵੈ ਸ਼ਕ ਹੁੰਦਾ ਹੈ ਕਿ ਉਸਨੂੰ ਸਹੀ ਲਿਖਿਆ ਹੈ ਲੋਕਾਂ ਨੂੰ ਪਸੰਦ ਆਵੇਗਾ ਜਾਂ ਨਹੀਂ ਆਵੇਗਾ ਉਸਦੀ ਚਿੰਤਾ ਜ਼ਾਇਜ ਹੈ ਪਰ ਕਦੇ ਵੀ ਉਸ ਨੂੰ ਆਪਣੀ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਉਸਦੀ ਲਿਖਤ ਵਿੱਚ ਕੋਈ ਖ਼ਰਾਬੀ ਹੋਵੇਗੀ ਸਾਡੀ ਲਿਖ਼ਤ ਕਾਫੀ ਚੰਗੀ ਨਾ ਹੋਣ 'ਤੇ ਵੀ ਸਾਨੂੰ ਆਪਣੇ ਉੱਪਰ ਕਦੇ ਵੀ ਸ਼ੱਕ ਨਹੀਂ ਹੋਣਾ ਚਾਹੀਦਾ ਸਾਡੇ ਦੁਆਰਾ ਉਸ ਲਿਖ਼ਤ ਨੂੰ ਸਹੀ ਤਰੀਕੇ ਨਾਲ ਹੀ ਵਰਤਿਆ ਜਾਣਾ ਚਾਹੀਦਾ ਹੈ ਸਾਡੇ ਸਾਡੇ ਦੁਆਰਾ ਜਦੋਂ ਅਸੀਂ ਕੋਈ ਵੀ ਲਿਖਦੇ ਹਾਂ ਤਾਂ ਉਸ ਵਿੱਚ ਜੋ ਗਲਤੀਆਂ ਰਹਿ ਜਾਂਦੀਆਂ ਹਨ ਸਾਨੂੰ ਉਸਨੂੰ ਸੁਧਾਰ ਕੇ ਅੱਗੇ ਦੇਣਾ ਚਾਹੀਦਾ ਹੈ ਨਾ ਕਿ ਸਾਨੂੰ ਸਵੈ ਸ਼ੱਕ ਕਰਨਾ ਚਾਹੀਦਾ ਹੈ ਸਾਡੇ ਦੁਆਰਾ ਲਿਖੀ ਗਈ ਲਿਖ਼ਤ ਨੂੰ ਸਾਡੇ ਪਰਿਵਾਰ ਵਿੱਚ ਸਾਡੇ ਮਹੱਲੇ ਵਿੱਚ ਸਾਡੇ ਦੋਸਤਾਂ ਮਿੱਤਰਾਂ ਵਿੱਚ ਕਾਫੀ ਵਾਰ ਚਲਾਇਆ ਗਿਆ ਹੈ ਕਈ ਵਾਰ ਸਹੀ ਨਾ ਹੋਣ 'ਤੇ ਵੀ ਸਾਨੂੰ ਹੌਂਸਲਾ ਦਿੱਤਾ ਗਿਆ ਹੈ ਇਸ ਤਰ੍ਹਾਂ ਹੀ ਸਾਨੂੰ ਹਮੇਸ਼ਾ ਹੌਂਸਲੇ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਕਦੇ ਵੀ ਆਪਣੇ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਅਸੀਂ ਕੰਮ ਕਰਨ ਅਤੇ ਲਿਖਤ ਨੂੰ ਇੱਕ ਸਮਰਥਨ ਦਿੰਦੇ ਹਾਂ ਕਿ ਜੋ ਵੀ ਉਹ ਕੰਮ ਕਰਦਾ ਹੈ ਉਹ ਸਹੀ ਕਰਦਾ ਹੈ ਕਿਸੇ ਦੇ ਹਾਵਾਂ ਭਾਵਾਂ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਕਈ ਵਾਰ ਕੋਈ ਆਪਣੀ ਸਵੈ ਜੀਵਣੀ ਲਿਖਦਾ ਹੈ ਜਿਸ ਵਿੱਚ ਬਹੁਤ ਗੁੱਸਾ ਬਹੁਤ ਦੁੱਖ ਭਰੀਆਂ ਗੱਲਾਂ ਹੁੰਦੀਆਂ ਹਨ ਜਿਸ ਵਿੱਚ ਸਾਨੂੰ ਹਮੇਸ਼ਾ ਸਹੀ ਤਰੀਕੇ ਨਾਲ ਚਲਣਾ ਚਾਹੀਦਾ ਹੈ ਕਈ ਵਾਰ ਉਹ ਚੀਜ਼ਾਂ ਆਪਾਂ ਨੂੰ ਪਸੰਦ ਨਹੀਂ ਹੁੰਦੀਆਂ ਪਰ ਉਹ ਲੇਖਕ ਦੁਆਰਾ ਪਸੰਦ ਕੀਤੀਆਂ ਜਾਂਦੀਆਂ ਹਨ ਜੋ ਉਸਨੇ ਲਿਖੀਆਂ ਹਨ ਉਸਨੇ ਸਾਨੂੰ ਹਮੇਸ਼ਾ ਸੋਚ ਸਮਝ ਕੇ ਹੀ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਮੈਨੂੰ ਬਹੁਤ ਪ੍ਰੇਰਿਤ ਮਿਲਿਆ ਹੈ ਜਦੋਂ ਮੈਂ ਲਿਖਦੀ ਹਾਂ ਤਾਂ ਮੇਰੇ ਪਰਿਵਾਰ ਵੱਲੋਂ ਮੈਨੂੰ ਬਹੁਤ ਉਤਸਾਹਿਤ ਕੀਤਾ ਜਾਂਦਾ ਹੈ ਧੰਨਵਾਦ